ਮੈਂ ਭੌਤਿਕ ਬੁ ਕਿਤਾਬਾਂ ਪੜ੍ਹਨੀਆਂ ਪਸੰਦ ਕਰਦਾ ਹਾਂ ਕਿਉਂ ਕਿਉਂਕਿ ਉਹਨਾਂ ਦੇ ਵਿੱਚੋਂ ਮੈਨੂੰ ਲੱਗਦਾ ਹੈ ਕਿ ਉਨ੍ਹਾਂ ਵਿਚੋਂ ਮੈਨੂੰ ਜ਼ਿਆਦਾ ਜਾਣਕਾਰੀ ਮਿਲੇਗੀ ਔਰ ਮੈਨੂੰ ਆਪਣੀ ਮਿੱਟੀ ਜਾਂ ਫਿਰ ਕਹਿ ਲਉ ਕਿ ਮੈਨੂੰ ਆਪਣੀ ਜ਼ਮੀਨ ਨਾਲ ਜੁੜਿਆ ਵਾ ਮਹਿਸੂਸ ਹੁੰਦਾ ਹੈ ਅਤੇ ਮੈਂ ਹਾਂ ਮੈਂ ਕਈ ਵਾਰ ਆਡੀਓ ਬੁਕਸ ਸੁਣੀਆਂ ਹਨ ਕਿਉਂਕਿ ਕਈ ਵਾਰ ਸਾਨੂੰ ਹਰੇਕ ਚੀਜ਼ ਭੌਤਿਕ ਕਿਤਾਬਾਂ ਤੋਂ ਨਹੀਂ ਪ੍ਰਾਪਤ ਹੋ ਸਕਦੀ ਤਾਂ ਇਸ ਲਈ ਇਹ ਮੈਨੂੰ ਕਈ ਵਾਰ ਉਨ੍ਹਾਂ ਨੂੰ ਵੀ ਸੁਣਨਾ ਪੈਂਦਾ ਹੈ